ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਭਾਸ਼ਾ ਹੁੰਦੀ ਹੈ ਇਸ ਦੀ ਲਿਪੀ ਗੁਰਮੁੱਖੀ ਹੈ ਪੰਜਾਬੀ ਭਾਸ਼ਾ ਦੇ ਗੀਤ ਵੀ ਬਹੁਤ ਵਧੀਆ ਹੁੰਦੇ ਹਨ ਅਤੇ ਪੂਰੇ ਭਾਰਤ ਵਿੱਚ ਹੀ ਸੁਣੇ ਜਾਂਦੇ ਹਨ ਪੰਜਾਬੀ ਗੀਤ ਅਤੇ ਫਿਲਮਾਂ ਕੈਨੇਡਾ ਅਮਰੈ ਅਮਰੀਕਾ ਵਿੱਚ ਵੀ ਸੁਣੇ ਜਾਂਦੇ ਹਨ ਲੋਕ ਪੰਜਾਬੀ ਇਸ ਫਿਲਮਾਂ ਨੂੰ ਬੜੇ ਹੀ ਦਿਲਚਸਪੀ ਨਾਲ਼ ਦੇਖਦੇ ਹਨ ਕਿਉਂਕਿ ਪੰਜਾਬੀ ਫਿਲਮਾਂ ਸਭ ਨੂੰ ਹੀ ਸਮਝ ਆਉਂਦੀਆਂ ਹਨ ਅੰਗਰੇਜ਼ੀ ਅੰਗ ਅੰਗਰੇਜ਼ੀ ਫਿਲਮਾਂ ਨੂੰ ਲੋਕ ਘੱਟ ਪਸੰਦ ਕਰਦੇ ਹਨ ਕਿਉਂਕਿ ਉਹਨਾਂ ਦੀ ਭਾਸ਼ਾ ਸਮਝ ਨਹੀਂ ਆਉਂਦੀ ਪਰ ਪੰਜਾਬੀ ਭਾਸ਼ਾ ਪਰ ਪੰਜਾਬੀ ਫਿਲਮਾਂ ਨੂੰ ਲੋਕ ਬੜੇ ਹੀ ਮਨੋਰੰਜਨ ਨਾਲ਼ ਦੇਖਦੇ ਹਨ ਕਿਉਂਕਿ ਪੰਜਾਬੀ ਭਾਸ਼ਾ ਹਰ ਇੱਕ ਦੇ ਸਮਝ ਵਿੱਚ ਆਉਂਦੀ ਹੈ ਪੰਜਾਬੀ ਭਾਸ਼ਾ ਦੇਸ਼ ਦੇ ਹਰ ਖੇਤਰ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਪ੍ਰਸਿ ਭਾਸ਼ਾ ਬਹੁਤ ਹੀ ਪ੍ਰਸਿੱਧ ਭਾਸ਼ਾ ਹੁੰਦੀ ਹੈ ਪੰਜਾਬੀ ਭਾਸ਼ਾ ਤੋਂ ਬਿਨਾਂ ਆਦਮੀ ਕੁਝ ਨਹੀਂ ਕਰ ਸਕਦਾ ਆਦਮੀ ਹਰ ਇੱਕ ਆਦਮੀ ਪੰਜਾਬੀ ਭਾਸ਼ਾ ਉੱਤੇ ਹੀ ਨਿਰਭਰ ਕਰਦਾ ਹੈ